ਜੇਕਰ ਅਸੀਂ ਕਲਾ ਦੇ ਖੇਤਰ ਦੀ ਗੱਲ ਕਰੀਏ ਤਾਂ ਦਿਨੋਂ ਦਿਨ ਇਹਦੇ ਵਿੱਚ ਨਵੀਆਂ ਤਕਨੀਕਾਂ ਨੇ ਜਿਹੜੀਆਂ ਉਹ ਲਾਹੇਵੰਦ ਸਾਬਤ ਹੋ ਰਹੀਆਂ ਨੇਗੀਆਂ ਮ ਕਿਉਂਕਿ ਇੰਟਰਨੈਟ ਇੱਕ ਅਜਿਹੀ ਸੁਵਿਧਾ ਗੀ ਸਾਡੇ ਕੋਲ ਅੱਜ ਦੇ ਸਮੇਂ ਦੇ ਵਿੱਚ ਜਿਸ ਨਾਲ ਤੁਸੀਂ ਆਪਣੇ ਕਲਾ ਦਾ ਪ੍ਰਦਰਸ਼ਨ ਹੈ ਜਿਹੜਾ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕਰ ਸਕਦੇ ਹੋ ਤੁਸੀਂ ਕਿਸ ਖਿੱਤੇ ਦੇ ਵਿੱਚ ਬੈਠੇ ਹੋ ਉੱਥੇ ਤੁਸੀਂ ਕਲਾ ਦੇ ਕਿਸ ਨਮੂਨੇ ਦੀ ਜਿਹੜੀ ਉਤਪਤੀ ਆ ਉਹ ਕਰ ਰਹੇ ਹੋ ਉਹ ਕੁਛ ਵੀ ਹੋ ਸਕਦੀ ਹੈ ਪੇਂਟਿੰਗ ਹੋ ਸਕਦੀ ਹੈ ਕੋਈ ਹਸਤਕਲਾ ਦੀਆਂ ਚੀਜ਼ਾਂ ਹੋ ਸਕਦੀਆਂ ਨੇਗੀਆਂ ਕੋਈ ਤੁਸੀਂ ਮਟਕੇ ਬਣਾ ਰਹੇ ਹੋ ਪੱਖੀਆਂ ਬਣਾ ਰਹੇ ਹੋ ਨਾਲੇ ਬਣਾ ਰਹੇ ਹੋ ਜਾਂ ਹੋਰ ਜੋ ਵੀ ਚੀਜ਼ਾਂ ਨੇ ਉਹ ਬਣਾ ਰਹੇ ਹੋ ਉਹਨਾਂ ਨੂੰ ਤੁਸੀਂ ਡਿਜੀਟਲੀ ਜਿਹੜੀ ਹੈਗੀ ਔਨਲਾਈਨ ਫੋਟੋਆਂ ਪਾ ਕੇ ਵੀਡੀਓ ਪਾ ਕੇ ਤੁਸੀਂ ਉਸ ਕਲਾ ਦੀ ਜਿਹੜੀ ਪ੍ਰਦਰਸ਼ਨੀ ਹੈ ਜਾਂ ਉਸ ਕਲਾ ਦਾ ਜਿਹੜਾ ਉਭਾਰ ਹੈ ਉਹਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਲੈ ਕੇ ਜਾ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਅਗਰ ਮੈਂ ਉਦਾਹਰਣ ਦੇ ਤੌਰ 'ਤੇ ਗੱਲ ਕਰਾਂ ਜਿਵੇਂ ਪਟਿਆਲੇ ਦੀ ਜੁੱਤੀ ਬਹੁਤ ਮਸ਼ਹੂਰ ਹੈ ਬੇਸ਼ੱਕ ਪਟਿਆਲਾ ਸ਼ਹਿਰ ਆ ਜਿਹੜਾ ਉਹ ਪੰਜਾਬ ਦੇ ਵਿੱਚ ਆਉਂਦਾ ਪਰ ਪਟਿਆਲੇ ਦੀ ਜਿਹੜੀ ਜੁੱਤੀ ਆ ਉਹ ਵਿਸ਼ਵ ਭਰ ਦੇ ਵਿੱਚ ਮਸ਼ਹੂਰ ਹੈ ਅਤੇ ਇਹਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਰੀਜਨ ਹੈ ਉਹ ਸਾਡੇ ਕੋਲ ਅਜੋਕੀ ਟੈਕਨੋਲੋਜੀ ਹੈ